ਸਤਿ ਸ਼੍ਰੀ ਅਕਾਲ ਜੀ ਬਾਲੀਵੁੱਡ ਅਤੇ ਟਾਲੀਵੁੱਡ ਨੇ ਭਾਰਤ ਵਿੱਚ ਹਰ ਥਾਂ ਫੈਸ਼ਨ ਦੇ ਰੁਝਾਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਅੱਜ ਕੱਲ੍ਹ ਲੋਕ ਜਿਵੇਂ ਦੇ ਕੱਪੜੇ ਟੀਵੀ ਵਿੱਚ ਅਕਸਰ ਫਿਲਮਾਂ ਅਦਾਕਾਰਾ ਪਾਉਂਦੀਆਂ ਹਨ ਉਵੇਂ ਦੇ ਕੱਪੜੇ ਪਾਉਣਾ ਪਸੰਦ ਕਰਦੇ ਹਨ ਕੁਝ ਕੁ ਫਿਲਮਾਂ ਜਿਵੇਂ ਕੀ ਮੈਨੂੰ ਬਾਜੀਰਾਓ ਮਸਤਾਨੀ ਵਿੱਚ ਜੋ ਦੀਪਿਕਾ ਪਾਦੂਕੋਨ ਨੇ ਕੱਪੜੇ ਪਾਏ ਹੈ ਮੈਨੂੰ ਉਸਦੀ ਸ਼ੈਲੀ ਬਹੁਤ ਸੋਹਣੀ ਲੱਗਦੀ ਹੈ ਜਿਵੇਂ ਜੋਧਾ ਅਕਬਰ ਸੀਰੀਅਲ ਵਿੱਚ ਜਿਵੇਂ ਦੇ ਉਹ ਕੱਪੜੇ ਪਹਿਨਦੇ ਹਨ ਉਵੇਂ ਦੀ ਸ਼ੈਲੀ ਬਹੁਤ ਸੋਹਣੀ ਲੱਗਦੀ ਹੈ ਪਰ ਮੈਂ ਕਦੇ ਕਿਸੇ ਵੀ ਫਿਲਮ ਦਾ ਪਹਿਰਾਵਾ ਸਮਾਨ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਮੇਰੇ ਕੋਲੇ ਇੰਨਾਂ ਸਮਾਂ ਨਹੀਂ ਹੁੰਦਾ ਮੈਨੂੰ ਸਲਵਾਰ ਸੂਟ ਬਣਾਉਣਾ ਪਸੰਦ ਹੈ ਜਿਵੇਂ ਕਿ ਰੱਬ ਦਾ ਰੇਡੀਓ ਫਿਲਮ ਵਿੱਚ ਬਣਾਇਆ ਗਿਆ ਸੀਗਾ ਬਾਜੀਰਾਓ ਮਸਤਾਨੀ ਵਿੱਚ ਜਿਹੜੀ ਜਿਹੜੀ ਫਰੋਕ ਦੀਪਿਕਾ ਪਾਦੂਕੋਨ ਨੇ ਬਣਾਈ ਸੀ ਪਾਈ ਹੋਈ ਸੀ ਉਹ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹ ਮੈਂ ਬਹੁਤ ਵਧੀਆ ਤਰੀਕੇ ਨਾਲ ਸਟਿਚ ਕਰ ਲਈ ਸੀ ਧੰਨਵਾਦ